ਪੰਜ ਦਸੰਬਰ ਉੱਨੀ ਸੌ ਵੀਹ ਛੇ ਜਨਵਰੀ ਉੱਨੀ ਸੌ ਅਠੱਤਰ ਗਿਆਰਾਂ ਫਰਵਰੀ ਉੱਨੀ ਸੌ ਬਾਹਠ ਦੋ ਜੂਨ ਉੱਨੀ ਸੌ ਅਠੱਤਰ ਇੱਕ ਜਨਵਰੀ ਦੋ ਹਜ਼ਾਰ ਚੌਵੀ